ਹਾਈਕਿੰਗ ਅਤੇ ਟਰੈਕਿੰਗ ਦੌਰਾਨ ਮੱਛਰਾਂ ਵਾਲੀ ਜਗ੍ਹਾ 'ਤੇ ਸਾਨੂੰ ਬੜੇ ਜ਼ਿਆਦਾ ਪ੍ਰਬੰਧ ਕਰਨੇ ਚਾਹੀਦੇ ਕਿਉਂਕਿ ਮੱਛਰ ਇੱਕ ਬੜੀ ਜ਼ਿਆਦਾ ਵੱਡੇ ਡਿਜੀਜ਼ ਕਰ ਦਿੰਦਾ ਹੈ ਉਹਦੇ ਰਾਹੀਂ ਸਾਨੂੰ ਬੜੀ ਜ਼ਿਆਦੀ ਬਿਮਾਰੀਆਂ ਲੱਗ ਜਾਂਦੀਆਂ ਹਨ ਸਾਨੂੰ ਡੇਂਗੂ ਹੋ ਜਾਂਦਾ ਹੈ ਟਾਈਫਾਈਡ ਹੋ ਜਾਂਦਾ ਹੈ ਸਾਨੂੰ ਬਹੁਤ ਕੁਛ ਹੋ ਸਕਦਾ ਵਾ ਮੱਛਰਾਂ ਨਾਲ ਅਤੇ ਸਾਨੂੰ ਉੱਥੇ ਇੱਕ ਟੈਂਟਰ ਨੈੱਟ ਰੱਖਣਾ ਚਾਹੀਦਾ ਵਾ ਮੱਛਰਾਂ ਵਾਲਾ ਜਿਹਦੇ ਅੰਦਰ ਮੱਛਰ ਨਾ ਆ ਪਾਉਣ ਅਸੀਂ ਉਹਦੇ ਅੰਦਰ ਸੌ ਸਕਦੇ ਹਾਂ ਉਹਦੇ ਹਿਸਾਬ ਨਾਲ ਹੀ ਵਧੀਆ ਰਹਾਂਗੇ ਬਿਨਾ ਮੱਛਰ ਤੋਂ ਅਤੇ ਉਹਦੇ ਲਈ ਅਸੀਂ ਕਈ ਚੀਜ਼ਾਂ ਵੀ ਯੂਜ ਕਰਦੇ ਕਈ ਕਰੀਮਾਂ ਵੀ ਯੂਜ ਕਰਦੇ ਸਕਦੇ ਹਾਂ ਜਿੱਦਾਂ ਓਡੋਮੋਸ ਅਤੇ ਕੁਛ ਵੀ ਤੇਲ ਤੂਲ ਵਗੈਰਾ ਅਸੀਂ ਲਾ ਸਕਦੇ ਉਹਦੇ ਨਾਲ ਮੱਛਰ ਸਾਨੂੰ ਅਵੋਇਡ ਕਰਦੇ ਆ ਸਾਡੇ ਤੋਂ ਦੂਰ ਜਾਂਦੇ ਆ ਮੱਛਰ ਉਹਦੇ ਰਾਹੀਂ ਅਸੀਂ ਆਪਣਾ ਵਧੀਆ ਕਰ ਸਕਦੇ ਹਾਂ ਅਤੇ ਇੱਕ ਵਾਰੀ ਸਾਡੇ ਨਾਲ ਵੀ ਇੱਦਾਂ ਹੋਇਆ ਸੀ ਅਸੀਂ ਵੀ ਟਰੈਕਿੰਗ 'ਤੇ ਗਏ ਸੀ ਇੱਕ ਵਾਰੀ ਅਤੇ ਅਸੀਂ ਉੱਥੇ ਸੋਏ ਸੀ ਪਰ ਸਾਡੇ ਕੋਲ ਨੈੱਟ ਨਹੀਂ ਸੀ ਸੌਣ ਲਈ ਅਤੇ ਅਸੀਂ ਉੱਥੇ ਬੈਠੇ ਰਹੇ ਅਤੇ ਸਾਨੂੰ ਮੱਛਰਾਂ ਨੇ ਬਹੁਤ ਤੰਗ ਕੀਤਾ ਸੀ ਰਾਤ ਨੂੰ ਅਸੀਂ ਸੌ ਨਹੀਂ ਪਾਏ ਸੀ ਬਿਲਕੁਲ ਵੀ ਅਤੇ ਸਾਨੂੰ ਪ੍ਰੋਪਰ ਇਹ ਉਹ ਹੋ ਗਏ ਸੀ ਦਾਣੇ ਹੋ ਗਏ ਸੀ ਸਾਨੂੰ ਸਾਨੂੰ ਪੂਰੇ ਮੱਛਰਾਂ ਨੇ ਕੱਟ ਕੱਟ ਕੇ ਸਾਨੂੰ ਦਾਣੇ ਦੂਣੇ ਕਰਤੇ ਸੀ ਅਤੇ ਉਹਦੇ ਰਾਹੀਂ ਅਸੀਂ ਉਹ ਤੋਂ ਬਾਅਦ ਅਸੀਂ ਓਡੋਮੋਸ ਲਾਈ ਸੀ ਉਹਦੇ ਨਾਲ ਕਰੀਮ ਲਾ ਕੇ ਉਹ ਸਾਨੂੰ ਸਹੀ ਹੋ ਗਿਆ ਸੀ